ਹਾਂਜੀ ਮੈਂ ਸ਼ੁੱਧ ਤੌਰ 'ਤੇ ਭੋਜਨ ਲਈ ਯਾਤਰਾ ਕੀਤੀ ਹੈ ਸਾਡੇ ਹੀ ਲਾਗੇ ਸਹੋੜਾ ਪਿੰਡ ਹੈ ਉੱਥੇ ਇੱਕ ਹੀ ਮਸ਼ਹੂਰ ਢਾਬਾ ਹੈ ਜਿੱਥੇ ਕਿ ਦਾਲ਼ ਮੱਖਣੀ ਬਹੁਤ ਹੀ ਵਧੀਆ ਮਿਲਦੀ ਹੈ ਉਹ ਖਾਣ ਲਈ ਮੈਂ ਸਪੈਸ਼ਲ ਉੱਥੇ ਜਾਂਦਾ ਹਾਂ